ਸਾਡਾ ਮਨਪਸੰਦ ਭੋਜਨ ਜਿਹੜਾ ਸਾਗ ਹੈ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਵੀ ਬਹੁਤ ਹੁੰਦੇ ਹਨ ਅਸੀਂ ਇਹਨੂੰ ਆਪਣੇ ਘਰ ਵਿੱਚ ਹੀ ਖਾਣਾ ਪਸੰਦ ਕਰਦੇ ਹਾਂ ਕਿਉਂਕਿ ਜਿਹੜਾ ਘਰ ਵਿੱਚ ਬਣਿਆ ਖਾਣਾ ਹੈ ਉਹ ਇੱਕ ਤਾਂ ਤਾਜ਼ਾ ਹੁੰਦਾ ਹੈ ਅਤੇ ਇੱਕ ਇਹਦਾ ਟੇਸਟ ਵੱਖਰਾ ਹੁੰਦਾ ਹੈ ਤਾਂ ਕਰਕੇ ਅਸੀਂ ਇਹਨੂੰ ਆਪਣੇ ਘਰ ਵਿੱਚ ਹੀ ਖਾਣਾ ਪਸੰਦ ਕਰਦੇ ਹਾਂ ਇਹਦੇ ਨਾਲ ਹੋਰ ਵੀ ਸਾਡੇ ਭੋਜਨ ਜਿਵੇਂ ਮਟਰ ਪਨੀਰ ਆ ਉਹ ਵੀ ਸਾਨੂੰ ਬਹੁਤ ਪਸੰਦ ਹੈ ਗਾਜਰਾਂ ਵੀ ਸਾਨੂੰ ਬਹੁਤ ਪਸੰਦ ਨੇ ਅਤੇ ਇਹ ਜਿਹੜਾ ਸਾਰਾ ਭੋਜਨ ਹੈ ਅਸੀਂ ਇਹਨੂੰ ਆਪਣੇ ਘਰ ਵਿੱਚ ਹੀ ਖਾਣਾ ਪਸੰਦ ਕਰਦੇ ਕਿਉਂਕਿ ਘਰ ਦਾ ਜਿਹੜਾ ਬਣਿਆ ਖਾਣਾ ਹੈ ਇੱਕ ਤਾਂ ਨਾ ਇਹਦੇ ਵਿੱਚ ਤੇਲ ਜ਼ਿਆਦਾ ਹੁੰਦਾ ਹੈ ਨਾ ਇਹਦੇ ਵਿੱਚ ਆਪਣੀ ਹੀ ਮਨਪਸੰਦ ਦੇ ਨਾਲ ਜੋ ਵੀ ਹੈ ਮਿਰਚ ਮਸਾਲੇ ਅਸੀਂ ਪਾ ਸਕਦੇ ਹਾਂ ਇਸ ਕਰਕੇ ਸਾਡੀ ਸਿਹਤ ਲਈ ਜਿਹੜਾ ਹੈ ਘਰ ਦਾ ਖਾਣਾ ਉਹ ਬਹੁਤ ਵਧੀਆ ਹੈ ਅਸੀਂ ਘਰ ਵਿੱਚ ਹੀ ਖਾਣਾ ਪਸੰਦ ਕਰਦੇ ਹਾਂ